ਜਦੋਂ ਮੈਂ ਪ੍ਰੋਪਟ ਦੇ ਅਧਾਰ 'ਤੇ ਕੋਈ ਚਿੱਤਰ ਬਣਾਉਂਦਾ ਹਾਂ ਤਾਂ ਮੈਂ ਆਪਣੀ ਸਿਖਲਾਈ 'ਤੇ ਭਰੋਸਾ ਕਰਦਾ ਹਾਂ ਜਿਸ ਵਿੱਚ ਕਲਾ ਸ਼ੈਲੀਆਂ ਸੰਕਲਪਾਂ ਅਤੇ ਡਿਜ਼ਾਇਨ ਸਿਦਾਰਾ ਦੇ ਦਾ ਗਿਆਨ ਸ਼ਾਮਿਲ ਹੁੰਦਾ ਹੈ ਮੈਂ ਵਿਅਕਤੀਗਤ ਚਿੱਤਰ ਬਣਾਉਣ ਲਈ ਖਾਸ ਆਨਲਾਈਨ ਜਾਂ ਔਫਲਾਈਨ ਸਰੋਤਾਂ ਦਾ ਹਵਾਲਾ ਨਹੀਂ ਦਿੰਦਾ ਪਰ ਮੈਂ ਇਸ ਦੀ ਬਜਾਏ ਮੈਂ ਉਹਨਾਂ ਪੇਂਟਰਾਂ ਅਤੇ ਸ਼ੈਲੀਆਂ ਦੇ ਆਧਾਰ 'ਤੇ ਵਿਜੁਅਲ ਤਿਆਰ ਕਰਦਾ ਹਾਂ ਜਿਹਨਾਂ 'ਤੇ ਮੈਨੂੰ ਸਿਖਲਾਈ ਦਿੱਤੀ ਗਈ ਹੈ ਰੋਪਟਾ ਨੂੰ ਸਮਝਣਾ ਮੈਂ ਸਭ ਤੋਂ ਪਹਿਲਾਂ ਸੰਦਰਭ ਮੁੱਖ ਵੇਰਵਿਆਂ ਅਤੇ ਸਮੁੱਚੀ ਵਾਈਵ ਨੂੰ ਸਮਝਣ ਲਈ ਪ੍ਰੋਪਟ ਦਾ ਵਿਸ਼ੇਸ਼ਣ ਕਰਦਾ ਹਾਂ ਉਦਾਹਰਨ ਲਈ ਜੇਕਰ ਤੁਸੀਂ ਲੈਂਡਸਕੈਪ ਦੀ ਮੰਗ ਕਰਦੇ ਹੋ ਤਾਂ ਮੈਂ ਲੈਂਡਸਕੈਪ ਦੀ ਕਿਸਮ ਰੰਗ ਮੁੱਢ ਅਤੇ ਪਹਾੜਾਂ ਰੁੱਖਾਂ ਜਾਂ ਪਾਣੀ ਵਰਗੀ ਕਿਸੇ ਖਾਸ ਤੱਤਾਂ ਦਾ ਵਿਚਾਰ ਕਰਦਾ ਹਾਂ